ਹੈਲੋ ਰਾਮ ਰਾਮ ਜੀ ਕਿੱਦਾਂ ਮੈਂ ਬਸ ਫ਼ੋਨ ਚਲਾਉਂਦੀ ਪਈ ਸੀ ਹੁਣੀ ਫਰੀ ਹੋਈ ਸੀ ਹਾਂਜੀ ਹਾਂਜੀ ਹੋ ਗਿਆ ਤਾਂ ਹੀ ਤਾਂ ਵਿਹਲੀ ਹੋਈ ਹਾਂ ਤੁਹਾਨੂੰ ਕਿਹਨੇ ਦਿੱਤੀ ਅੱਛਾ ਕਿੰਨੇ ਕੁ ਵਜੇ ਜਾਵਾਂਗੇ ਚਲੋ ਫੇਰ ਹੁਣੇ ਚੱਲਦੇ ਹਾਂ ਅੱਧੇ ਘੰਟੇ 'ਚ ਮਿਲਦੇ ਹਾਂ ਫਿਰ ਤਾਂ ਲਾਗੇ ਆ ਫਿਰ ਤਾਂ ਪੈਦਲ ਹੀ ਚੱਲ ਜਾਵਾਂਗੇ ਚਲੋ ਠੀਕ ਹੈ ਚਲੋ ਮੈਂ ਤਿਆਰ ਹੋ ਕੇ ਕਰਦੀ ਫਿਰ ਫ਼ੋਨ ਰਾਮ ਰਾਮ ਜੀ